ਭਾਰਤ ਦੀ ਆਜ਼ਾਦੀ ਵੇਲੇ ਸੰਨ ਉੱਨੀ ਸੌ ਸੰਤਾਲੀ ਈਸਵੀ ਵਿੱਚ ਜਦੋਂ ਬਹੁਤ ਹੀ ਵੱਡਾ ਘੱਲੂਘਾਰਾ ਹੋਇਆ ਮੁਸਲਮਾਨ ਲੋਕ ਜੋ ਹਿੰਦੁਸਤਾਨ ਵਿੱਚ ਸੀ ਉਹ ਪਾਕਿਸਤਾਨ ਵਿੱਚ ਚਲੇ ਗਏ ਪਾਕਿਸਤਾਨ ਤੋਂ ਜੋ ਹਿੰਦੂ ਲੋਕ ਸੀ ਉਹ ਹਿੰਦੁਸਤਾਨ ਵਿੱਚ ਆਏ ਉਸ ਵੇਲੇ ਬਹੁਤ ਹੀ ਆਜ਼ਾਦੀ ਦੀ ਵੱਡੀ ਲਹਿਰ ਚੱਲੀ ਹੋਈ ਸੀ ਜਿਵੇਂ ਭਗਤ ਸਿੰਘ ਲਾਲਾ ਲਾਜਪਤ ਰਾਏ ਕਰਤਾਰ ਸਿੰਘ ਆਪਣਾ ਭਗਤ ਸਿੰਘ ਦੇ ਸਾਥੀ ਆਜ਼ਾਦੀ ਦੇ ਗੁਲਾਟੀਏ ਸਨ ਜਿਨ੍ਹਾਂ ਕਰਕੇ ਹਿੰਦੁਸਤਾਨ ਆਜ਼ਾਦ ਹੋਇਆ ਉਸ ਤੋਂ ਬਾਅਦ ਆਜ਼ਾਦੀ ਤੋਂ ਮਗਰੋਂ ਜਦੋਂ ਹਿੰਦੁਸਤਾਨ ਆਪਣੀ ਇੰਡੀਪੈਂਡੈਂਟ ਕਮਾਂਡ ਆਈ ਤਾਂ ਆਪਣੇ ਆਜ਼ਾਦੀ ਦੇ ਲਹਿਰ ਵਿੱਚ ਆਪਣੇ ਹੀ ਕਾਨੂੰਨ ਆਪਣੇ ਬਹੁਤ ਹੀ ਮਹੱਤਵਪੂਰਨ ਘਟਨਾਵਾਂ ਹੋਈਆਂ ਜਿਨ੍ਹਾਂ ਕਰਕੇ ਹਿੰਦੁਸਤਾਨ ਆਜ਼ਾਦ ਹੋ ਗਿਆ ਦੇਖਿਆ ਜਾਵੇ ਤਾਂ ਭਗਤ ਸਿੰਘ ਔਰ ਲਾਲਾ ਲਾਜਪਤ ਰਾਏ ਸੁਖਦੇਵ ਗੁਰੂ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਆਜ਼ਾਦੀ ਦੇ ਬਹੁਤ ਵੱਡੇ ਨੇਤਾ ਹਨ ਜਿਨ੍ਹਾਂ ਸਦਕਾ ਆਪਣੀਆਂ ਜਿਨ੍ਹਾਂ ਦੀ ਕੁਰਬਾਨੀਆਂ ਸਦਕਾ ਆਪਣੇ ਦੇਸ਼ ਵਿੱਚ ਮਹੱਤਵਪੂਰਨ ਆਜ਼ਾਦ ਭਾਰਤ ਦੀ ਆਜ਼ਾਦੀ ਤੋਂ ਬਾਅਦ ਆਜ਼ਾਦ ਹਿੰਦ ਦੇ